ਬਹੁਤ ਸਾਰੇ ਜੈਈ ਘਰ ਸਾਡੇ ਨੇੜੇ ਜਿੱਥੇ ਹੈਗੇ ਹਨ ਜੋ ਕਿ ਸਕੂਲ ਦੇ ਬੱਚੇ ਅਜਾਇਬ ਘਰ ਦੇਖਣ ਜਾਂਦੇ ਹਨ ਚਿੜੀਆ ਘਰ ਦੇਖਣ ਜਾਂਦੇ ਹਨ ਸਾਡੇ ਨੇੜੇ ਤੇੜੇ ਖੇਤ ਵੀ ਹੈਗੇ ਹੈ ਉਹ ਵੀ ਦੇਖਣ ਜਾਂਦੇ ਹਨ ਉਹ ਵੀ ਖੇਤ ਘੁੰਮਣ ਜਾਂਦੇ ਹਨ ਪੇੜ ਪੌਦੇ ਫ਼ਸਲਾਂ ਜੋ ਵੀ ਪਸ਼ੂ ਪੰਛੀ ਸਭ ਕੁਝ ਦੇਖਣ ਜਾਂਦੇ ਹਨ ਪੇੜ ਪੌਦੇ ਵੀ ਤਾਂ ਦੇਖਣ ਜਾਂਦੇ ਹਨ ਬੱਚਿਆਂ ਨੂੰ ਵਧੀਆ ਮਹਿਸੂਸ ਹੁੰਦਾ ਹੈ ਅਤੇ ਉਕਸ਼ਾ ਅਤੇ ਹਰਿਆਲੀ ਉਹਨਾਂ ਨੂੰ ਦੇਖਣ ਨੂੰ ਮਿਲਦੀ ਹੈ ਆਪਣੇ ਸਮਾਜ ਵਿੱਚ ਪਸ਼ੂ ਪੰਛੀ ਵਾਲੇ ਜਾਣਕਾਰੀ ਬਹੁਤ ਮਿਲਦੀ ਹੈ ਚਿੜੀਆ ਕਿਹੋ ਜਿਹੀ ਹੁੰਦੀ ਹੈ ਜੋ ਵੀ ਹੈ ਗਾਂ ਪਸ਼ੂ ਪੰਛੀ ਕਿਹੋ ਜਿਹੇ ਹੁੰਦੇ ਹਨ ਇਸ ਕਰਕੇ ਸਾਡੇ ਖੇਤਾਂ 'ਚ ਨੇੜੇ ਨੇੜੇ ਇਲਾਕਿਆਂ 'ਚ ਪਸ਼ੂ ਪੰਛੀ ਹੁੰਦੇ ਹਨ ਇਸ ਕਰਕੇ ਦਈ ਘਰ ਵੀ ਖੁੱਲੇ ਹੋਏ ਹਨ ਜੋ ਵੀ ਖੇਤਾਂ 'ਚ ਘੁੰਮਣ ਜਾਂਦੇ ਆਕਸੀਜਨ ਵਗੈਰਾ ਬਹੁਤ ਮਿਲਦੀ ਹਨ ਸਕੂਲ ਦੇ ਬੱਚੇ ਸਕੂਲ ਵਾਲੇ ਬੱਚਿਆਂ ਨੂੰ ਅਦਾਈ ਘਰ ਦਿਖਾਉਣ ਲਈ ਲੈ ਕੇ ਜਾਂਦੇ ਹਨ ਜਿੱਥੇ ਸ਼ੇਰ ਭਾਲੂ ਚੀਤਾ ਬਾਂਦਰ ਚਿੜੀਆ ਹੋਰ ਵੀ ਬਹੁਤ ਸਾਰੇ ਜਾਨਵਰ ਦੇਖਣ ਨੂੰ ਮਿਲਦੇ ਮ ਮਿਲਦੇ ਹਨ ਜੋ ਕਿ ਚਿੜੀਆ ਘਰ ਵਗੈਰਾ ਪਸ਼ੂ ਪੰਛੀ ਅਤੇ ਮਨੋਰੰਜਨ ਬੱਚਿਆਂ ਦਾ ਹੋ ਜਾਂਦਾ ਮਨ ਅਤੇ ਪਸ਼ੂ ਪਸ਼ੂ ਪੰਛੀ ਵੀ ਖੁਸ਼ ਹੋ ਜਾਂਦੇ ਹਨ